ਹੈਲੋ ਪੰਜਾਬ ਵਿੱਚ ਖੇਤੀਬਾੜੀ ਹੁੰਦੀ ਆ ਝੋਨਾ ਲੱਗਦਾ ਕਣਕ ਲੱਗਦਾ ਸਭ ਕੁਝ ਪੰਜਾਬ ਵਿੱਚੋਂ ਬਾਹਰ ਜਾਂਦਾ ਹੈ ਪੰਜਾਬ ਦੇ ਕਈ ਖਿਡਾਰੀ ਵੀ ਹਨ ਜੋ ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ ਆਉਂਦੇ ਹਨ ਅਤੇ ਮੈਡਲ ਵਗੈਰਾ ਲੈ ਕੇ ਆਉਂਦੇ ਨੇ ਪੰਜਾਬ ਵਿੱਚ ਝੋਨਾ ਕਣਕ ਸਬਜ਼ੀਆਂ ਫ਼ਲ ਸਭ ਕੁਛ ਉਗਾਇਆ ਜਾਂਦਾ ਹੈ ਜੋ ਕਿ ਬਾਹਰ ਟਰਾਂਸਫਰ ਕੀਤਾ ਜਾਂਦਾ ਹੈ ਬਹੁਤ ਜਗ੍ਹਾ 'ਤੇ ਟਰਾਂਸਫਰ ਹੁੰਦਾ ਹੈ ਜਿਵੇਂ ਕਣਕ ਤਾਂ ਪਿੰਡ ਪਿੰਡ ਵਿੱਚ ਜਾਂਦੀ ਹੈ ਅਤੇ ਝੋਨਾ ਵੀ ਪਿੰਡਾਂ ਪਿੰਡਾਂ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਸਹੂਲਤ ਪ੍ਰਾਪਤ ਹੋਏ ਓਕੇ ਬਾਏ